ਵੱਡੇ ਪੱਧਰ 'ਤੇ ਬਾਗਬਾਨੀ ਜਾਂ ਫੁੱਲਾਂ ਦੀ ਖੇਤੀ ਮੇਰੇ ਵੱਲੋਂ ਨਹੀਂ ਕੀਤੀ ਜਾ ਰਹੀ ਇਹ ਇੱਕ ਮੇਰਾ ਸ਼ੌਕ ਹੈ ਜੋ ਮੈਂ ਆਪਣੇ ਘਰ ਦੇ ਵਿੱਚ ਛੋਟੀ ਜਿਹੀ ਖੇਤੀ ਕਰ ਰਹੀ ਹਾਂ ਉਹਦੇ 'ਚ ਮੈਂ ਆਪਣਾ ਪੂਰਾ ਕਰਦੀ ਹਾਂ ਪਰੰਤੂ ਮੈਂ ਬੀਜ ਜਾਂ ਪੌਦੇ ਨੇੜੇ ਦੀ ਨਰਸਰੀ ਤੋਂ ਪ੍ਰਾਪਤ ਕਰਦੀ ਹਾਂ ਪੌਦੇ ਕਈ ਕਿਸਮ ਦੇ ਹੁੰਦੇ ਹਨ ਕਈਆਂ ਨੂੰ ਖਾਦ ਦੀ ਜ਼ਰੂਰਤ ਹੁੰਦੀ ਹੈ ਕਈਆਂ ਨੂੰ ਪਾਣੀ ਦੀ ਅਤੇ ਕਈਆਂ ਨੂੰ ਹਵਾ ਦੀ ਅਲੱਗ ਅਲੱਗ ਕਿਸਮ ਨਾਲ ਪੌਦੇ ਉੱਗਦੇ ਹਨ ਅਲੱਗ ਅਲੱਗ ਇਹਨਾਂ ਵਿੱਚ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਖਾਦ ਵੀ ਕਈ ਕਿਸਮ ਦੀ ਹੁੰਦੀ ਹੈ ਜਿਵੇਂ ਕੈਂਚਿਊਏ ਦੀ ਖਾਦ ਹੋ ਗਈ ਗੋਬਰ ਦੀ ਖਾਦ ਹੋ ਗਈ ਅਲੱਗ ਅਲੱਗ ਤਰ੍ਹਾਂ ਦੀ ਖਾਦ ਆਉਂਦੀ ਹੈਗੀ ਆ ਜੋ ਅਲੱਗ ਅਲੱਗ ਫਲ ਜਾਂ ਸਬਜ਼ੀਆਂ ਵਿੱਚ ਪਾਈ ਜਾਂਦੀ ਹੈ ਹਰ ਇੱਕ ਖਾਦ ਦਾ ਇੱਕ ਆਪਣਾ ਹੀ ਯੋਗਦਾਨ ਹੁੰਦਾ ਹੈ ਪੌਦਿਆਂ ਦੇ ਵਿਕਾਸ ਵਾਸਤੇ ਕਈ ਪੌਦਿਆਂ ਨੂੰ ਜ਼ਿਆਦਾ ਪਾਣੀ ਜਾਂ ਖਾਦ ਜ਼ਰੂਰਤ ਨਹੀਂ ਹੁੰਦੀ ਉਹ ਇੰਝ ਵੀ ਬਹੁਤ ਛੇਤੀ ਨਾਲ ਉੱਗਦੇ ਹਨ ਜਿਵੇਂ ਕਿ ਅਗਰ ਤੁਸੀਂ ਮਨੀ ਪਲਾਂਟ ਲਗਾਉਂਦੇ ਹੋ ਮਨੀ ਪਲਾਂਟ ਨੂੰ ਸਿਰਫ ਪਾਣੀ ਦੀ ਜ਼ਰੂਰਤ ਹੈ ਉਸ ਦਾ ਪਾਣੀ ਵੀ ਸਾਨੂੰ ਰੋਜ਼ ਨਹੀਂ ਚੇਂਜ ਕਰਨਾ ਪੈਂਦਾ